ਭੰਗੜੇ ਦੇ ਪ੍ਰਦਰਸ਼ਨ ਵਿੱਚ ਆਮ ਤੌਰ 'ਤੇ ਮੁੰਡਿਆਂ ਵੱਲੋਂ ਕੁੜਤਾ ਅਤੇ ਚਾਦਰਾ ਪਾਇਆ ਜਾਂਦਾ ਹੈ ਉਹਨਾਂ ਦੇ ਗਲ ਵਿੱਚ ਕੈਂਠਾ ਅਤੇ ਸਿਰ 'ਤੇ ਪੱਗਾਂ ਬੰਨ੍ਹੀਆਂ ਹੁੰਦੀਆਂ ਹਨ ਅਤੇ ਕੁੜੀਆਂ ਵੱਲੋਂ ਘਾਗਰੇ ਅਤੇ ਸੂਟ ਪਾਏ ਜਾਂਦੇ ਹਨ ਅਤੇ ਸਿਰ 'ਤੇ ਫੁਲਕਾਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਪਹਿਰਾਵਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ ਅਤੇ ਇਹ ਇਹਨਾਂ ਨੂੰ ਬਹੁਤ ਜ਼ਿਆਦਾ ਆਕਰਸ਼ਿਤ ਬਣਾਉਂਦਾ ਹੈ ਇਹ ਦੂਸਰਿਆਂ ਤੋਂ ਵੱਖ ਲੱਗਦੇ ਹਨ ਅਤੇ ਇਹ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਅਤੇ ਇਹਦੇ 'ਚ ਭੰਗੜਾ ਜਦੋਂ ਪਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਕੰਫਰਟੇਬਲ ਵੀ ਹੁੰਦਾ ਹੈ ਅਤੇ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦੇ ਹਨ ਅਤੇ ਦੁਨੀਆਂ ਵੇਖ ਕੇ ਦੱਸ ਸਕਦੀ ਏ ਇਹ ਭੰਗੜੇ ਵਾਲੇ ਹਨ ਉਹਨਾਂ ਦੀ ਪੋਸ਼ਾਕ ਵੱਧ ਤੋਂ ਜ਼ਿਆਦਾ ਜ਼ਿਆਦਾ ਆਕਰਸ਼ਿਤ ਹੁੰਦੀ ਹੈ ਇਹ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਰੰਗ ਬਿਰੰਗੀਆਂ ਪੱਗਾਂ ਬੰਨ੍ਹੀਆਂ ਜਾਂਦੀਆਂ ਹਨ ਅਤੇ ਚਿੱਟੇ ਕੁੜਤੇ ਅਤੇ ਚਾਦਰੇ ਲਾਏ ਜਾਂਦੇ ਹਨ ਪੱਗਾਂ ਅਤੇ ਕੈਂਠੇ ਬਹੁਤ ਜ਼ਿਆਦਾ ਸੋਹਣੇ ਹੁੰਦੇ ਹਨ